ਨਮਸਕਾਰ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਆਪਾਂ ਤਸਵੀਰਾਂ ਕਿਸ ਤਰ੍ਹਾਂ ਅੱਜਕੱਲ੍ਹ ਦੇ ਦੌਰ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਗਈਆਂ ਆਪਾਂ ਸਾਰਿਆਂ ਦੇ ਲਈ ਕੈਮਰਾ ਤਾਂ ਬੜੇ ਸਾਲਾਂ ਤੋਂ ਜਿਹੜਾ ਹੈ ਕਿ ਸਾਡੀ ਜ਼ਿੰਦਗੀ 'ਚ ਬੜਾ ਇਮਪੋਰਟੈਂਟ ਅਤੇ ਬੜਾ ਮਹੱਤਵਪੂਰਨ ਇੱਕ ਔਜ਼ਾਰ ਜਾਂ ਔਜ਼ਾਰ ਕਹਿ ਦਈਏ ਅਪਲਾਈਸ ਕਹਿ ਦਈਏ ਬਣਿਆ ਹੋਇਆ ਹੈ ਕੈਮਰਾ ਪਹਿਲਾਂ ਹੁੰਦੇ ਸੀ ਜਿਹਦੇ ਰੋਲ ਪੈਂਦਾ ਸੀ ਅਤੇ ਫੋਟੋ ਸ਼ੂਟ ਹੁੰਦਾ ਸੀ ਉਹ ਸਿੰਪਲ ਕੈਮਰਾ ਹੁੰਦਾ ਸੀ ਫਲੈਸ਼ ਲੱਗ ਜਾਂਦੀ ਸੀ ਉਹਦੇ ਉੱਪਰ ਅੱਜ ਕੱਲ੍ਹ ਕੈਮਰਾ ਫੋਨਾਂ 'ਚ ਵੀ ਆ ਰਿਹਾ ਹਾਈ ਟੈਕ ਕੈਮਰਾ ਆ ਰਿਹਾ ਅਤੇ ਹੋਰ ਵੀ ਫੋਟੋਗ੍ਰਾਫੀ ਲਈ ਬਹੁਤ ਜ਼ਿਆਦਾ ਚੰਗੇ ਅਤੇ ਬਹੁਤ ਵਧੀਆ ਕੈਮਰੇ ਆ ਰਹੇ ਨੇ ਜਿਵੇਂ ਹੈ ਕਿ ਅੱਜ ਕੱਲ੍ਹ ਹਰ ਜਗ੍ਹਾ 'ਤੇ ਕੈਮਰੇ ਦੀ ਲੋੜ ਪੈਂਦੀ ਹੈ ਅੱਜ ਕੱਲ੍ਹ ਆਪਾਂ ਆਪਣੇ ਘਰ ਕਿਸੇ ਕਿਸੇ ਦਾ ਜਨਮਦਿਨ ਹੁੰਦਾ ਹੈ ਅਤੇ ਤਾਂ ਵੀ ਆਪਾਂ ਫੋਟੋਸ ਖਿੱਚਦੇ ਆ ਇਹ ਕੈਮਰਾ ਅੱਜ ਕੱਲ੍ਹ ਕਿਵੇਂ ਕਿ ਡਿਫਰੈਂਟ ਡਿਫਰੈਂਟ ਅਲੱਗ ਅਲੱਗ ਮੋਡ ਲੱਗ ਸਕਦੇ ਨੇ ਮੋਡ ਲਾਏ ਜਾ ਸਕਦੇ ਨੇ ਦਿਨ ਵਾਸਤੇ ਰਾਤ ਵਾਸਤੇ ਅਤੇ ਕਈ ਜ਼ਿਆਦਾ ਐਪਸ ਵੀ ਹੈਗੇ ਜਿਵੇਂ ਸਨੈਪਚੈਟ ਨਾਮ ਦੀ ਇੱਕ ਐਪ ਹੈ ਉਹਦੇ ਕਈ ਮੋਡਜ਼ ਹੈਗੇ ਹੈ ਬਿਊਟੀਫੁਟ ਬਿਊਟੀਫੁਲ ਫੋਟੋਜ਼ ਆ ਜਾਂਦੀਆਂ ਉਹਦੇ ਨਾਲ ਅਤੇ ਇਹਦੇ 'ਚ ਕਿਵੇਂ ਕਿ ਆਪਾਂ ਵਿਆਹ ਸ਼ਾਦੀ ਵੀ ਕਰਦੇ ਹਾਂ ਤਾਂ ਵੀ ਆਪਾਂ ਨੂੰ ਕੈਮਰੇ ਦੀ ਲੋੜ ਪੈਂਦੀ ਅੱਜ ਕੱਲ੍ਹ ਵਿਆਹ ਸ਼ਾਦੀ ਕੈਮਰੇ ਤੋਂ ਬਿਨਾਂ ਹੁੰਦੀ ਨਹੀਂ ਬੜਾ ਡਿਜੀਟਲ ਅਤੇ ਬੜਾ ਬੜਾ ਟੋਪ ਟੈਕਨੀਕ ਦੀ ਯੂਜ਼ ਹੁੰਦੀ ਹੈ ਅੱਜ ਕੱਲ੍ਹ ਸ਼ਾਦੀਆਂ ਦੇ ਕੈਮਰੇ ਦੇ ਵਿੱਚ ਇਸ ਤਰ੍ਹਾਂ ਨਾਲ ਕੈਮਰਾ ਅੱਜ ਕੱਲ੍ਹ ਦੀ ਬਹੁਤ ਜ਼ਿਆਦਾ ਜ਼ਰੂਰਤ ਬਣ ਚੁੱਕਿਆ ਹੈ ਅਤੇ ਆਪਣੀ ਲਾਈਫ ਵਿੱਚ ਬਹੁਤ ਵੱਡਾ ਅਤੇ ਇਮਪੋਰਟੈਂਟ ਰੋਲ ਪਲੇ ਕਰ ਰਿਹਾ ਆਪਾਂ ਕਿਤੇ ਵੀਡੀਓ ਚੈਟ ਵੀ ਕਰਦੇ ਤਾਂ ਕੈਮਰੇ ਦੀ ਲੋੜ ਪੈਂਦੀ ਉਹਦੇ ਲਈ ਜਿਵੇਂ ਆਪਣੇ ਫੋਨ ਫਰੰਟ ਕੈਮਰਾ ਯੂਜ਼ ਹੁੰਦੇ ਨੇ ਜਿਹੜੇ ਬੇਸਿਕ ਹੁੰਦੇ ਨੇ ਇਸ ਤਰ੍ਹਾਂ ਕੈਮਰਾ ਬਹੁਤ ਜ਼ਿਆਦਾ ਜ਼ਰੂਰੀ ਬਣ ਚੁੱਕਿਆ ਬਹੁਤ ਬਹੁਤ ਧੰਨਵਾਦ